ਮੈਂ ਫਾਰਮ ਵਿੱਚ ਬਹੁਤ ਸਾਰਾ ਸਮਾਂ ਲਗਾਉਂਦੀ ਹਨ ਜਿਵੇਂ ਕਿ ਫਸਲਾਂ ਦੀ ਉਗਾਈ ਮੌਸਮ ਦੇ ਹਿਸਾਬ ਨਾਲ ਕੀਤੀ ਜਾਂਦੀ ਹਨ ਅਤੇ ਉਸਨੂੰ ਸਵੇਰੇ ਤੋਂ ਲੈ ਕੇ ਫਾਰਮ ਵਿੱਚ ਬਹੁਤ ਸਾਰਾ ਸਮਾਂ ਲੱਗ ਜਾਂਦਾ ਹਨ ਜਿਵੇਂ ਕਿ ਸਬਜ਼ੀ ਹੁੰਦੀ ਹਨ ਮਿਰਚਾਂ ਭਿੰਡੀਆਂ ਆਦਿ ਹੁੁੰਦੀਆਂ ਹਨ ਉਹ ਬਹੁਤ ਸਾਰੀਆਂ ਸਬਜ਼ੀਆਂ ਨੂੰ ਤੋੜਨਾ ਵੀ ਹੁੰਦਾ ਹੈ ਅਗਰ ਸ ਟੈਮ ਸਿਰ ਨਾ ਤੋੜੇ ਤੋ ਉਸ ਮੇ ਬਹੁਤ ਸਾਰੀ ਦਿੱਕਤ ਆ ਜਾਂਦੀ ਹੈ ਸਬਜ਼ੀ ਦੇ ਫਾਰਮ ਵਿੱਚ ਬਹੁਤ ਹੀ ਸਮਾਂ ਲੱਗ ਜਾਂਦਾ ਹੈ ਉਸਦੇ ਨਾਲ ਅਸੀਂ ਬਹੁਤ ਹੀ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਸਾਨੂੰ ਬਹੁਤ ਸਾਰੇ ਫਾਰਮ ਹੁੰਦੇ ਹਨ ਜਿਵੇਂ ਕਿ ਪਸ਼ੂਆਂ ਦਾ ਫਾਰਮ ਹੁੰਦਾ ਹਨ ਮੁਰਗੀ ਫਾਰਮ ਹੋ ਗਿਆ ਮੱਛੀ ਫਾਰਮ ਹੋ ਗਿਆ ਉਹਦੇ ਵਿੱਚ ਅਸੀਂ ਬਹੁਤ ਸਾਰੀ ਬਹੁਤ ਸਾਰੀ ਕੰਮ ਕਰਨਾ ਪੈਂਦਾ ਹੈ ਗਾਂ ਗਾਂਇਆ ਦਾ ਫਾਰਮ ਵੀ ਹੁੰਦਾ ਹੈ ਉਸ ਵਿੱਚ ਛੋਟੇ ਛੋਟੇ ਬੱਚੇ ਵੀ ਹੁੰਦੇ ਹਨ ਅਤੇ ਬਹੁਤ ਸਾਰੀਆਂ ਚੀਜਾਂ ਜਿਵੇਂ ਕਿ ਉਹਨਾਂ ਨੂੰ ਪਾਣੀ ਪਿਲਾਉਣਾ ਗਾਸ ਡਾਲ ਡਾਲਨਾ ਔਰ ਵੀ ਬਹੁਤ ਸਾਰੀਆਂ ਕੰਮ ਹੁੰਦੇ ਹੈ ਉਸ ਵਿੱਚ ਅਸੀਂ ਮੱਝਾਂ ਵੀ ਰੱਖਦੇ ਹਨ ਮੱਝਾਂ ਦਾ ਦੁੱਧ ਨਿਕਾਲਣਾ ਹੁੰਦਾ ਹੈ ਅਤੇ ਉਸਨੂੰ ਫਿਰ ਡੇਅਰੀ ਜਾਂ ਆਪਣੇ ਰੁਜ਼ਗਾਰ ਲਈ ਵੇਚਣ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੋਰ ਇਸ ਵਿੱਚ ਅਸੀਂ ਬਿਲਕੁਲ ਵੀ ਬਹੁਤ ਜ਼ਿਆਦਾ ਸਮਾਂ ਫਾਰਮ ਵਿੱਚ ਹੀ ਬਿਤਾਉਂਦੇ ਹਨ ਅਤੇ ਘਰ ਵਿੱਚ ਜਾਣ ਲਈ ਸਾਨੂੰ ਬਹੁਤ ਘੱਟ ਸਮਾਂ ਮਿਲਦਾ ਹੈ ਔਰ ਸਾਨੂੰ ਇਸ ਵਿੱਚ ਸਭ ਤੋਂ ਜ਼ਿਆਦਾ ਜਿਵੇਂ ਸਬਜ਼ੀਆਂ ਦੀ ਦੇਖ ਭਾਲ ਲਈ ਵੱਧ ਤੋਂ ਵੱਧ ਜ਼ਿਆਦਾ ਸਮਾਂ ਲੱਗ ਜਾਂਦਾ ਹਨ